ਜਿਵੇਂ ਕਿ ਮੈਂ ਰੋਪੜ ਖੇਤਰ ਵਿੱਚ ਰਹਿੰਦਾ ਇੱਥੇ ਬਹੁਤ ਸਾਰਾ ਪੰਛੀ ਰਹਿੰਦੇ ਹਨ ਜਿਵੇਂ ਕਿ ਚਿੜੀ ਗਟਾਰ ਬੰਗਲਾ ਤੋਤਾ ਕੋਇਲ ਬੰਬੀਹਾ ਇੱਲ ਕਬੂਤਰ ਮੋਰ ਬਾਜ਼ ਜਿਵੇਂ ਕਿ ਆਪਾਂ ਸੰਖੇਪ ਵਿੱਚ ਗੱਲ ਕਰੀਏ ਕਬੂਤਰ ਕਬੂਤਰ ਜਿਵੇਂ ਕਿ ਲੋਕ ਅੱਜ ਕੱਲ੍ਹ ਸ਼ੌਂਕ ਨੂੰ ਕਬੂਤਰ ਰੱਖਦੇ ਨੇ ਜਿਵੇਂ ਕਿ ਚੀਨੇ ਕਬੂਤਰ ਅਤੇ ਇਹਨਾਂ 'ਤੇ ਟੂਰਨਾਮੈਂਟ ਵੀ ਹੁੰਦੇ ਨੇ ਇਹ ਜੋ ਸਭ ਤੋਂ ਜ਼ਿਆਦਾ ਹਵਾ ਵਿੱਚ ਉੱਡਦਾ ਹੈ ਉਹ ਵਿਜੇਤਾ ਹੁੰਦਾ ਹੈ ਜੇ ਗੱਲ ਕਰੀਏ ਮੋਰ ਦੀ ਮੋਰ ਇ ਆਪਣਾ ਰਾਸ਼ਟਰੀ ਪੰਛੀ ਵੀ ਹੈ ਅਤੇ ਜਦੋਂ ਮੀਂਹ ਦਾ ਮੌਸਮ ਹੁੰਦਾ ਹੈ ਤਾਂ ਮੋਰ ਪੈਲ ਵੀ ਪਾਉਂਦਾ ਹੈ ਅਤੇ ਉਹ ਬਹੁਤ ਸੋਹਣਾ ਲੱਗਦਾ ਹੈ ਦੇਖਣ ਨੂੰ ਵੀ ਇੱਲ ਦੀ ਗੱਲ ਕਰੀਏ ਇੱਲ ਸਭ ਤੋਂ ਉੱਚਾ ਉੱਡਣ ਵਾਲਾ ਪੰਛੀ ਹੈ ਅਤੇ ਇਸ ਮੀਲਾਂ ਮੀਲਾਂ ਦੂਰ ਉੱਡੀ ਜਾਂਦਾ ਹੈ ਅਤੇ ਇੱਕ ਸ਼ਹਿਰ ਤੋਂ ਦੂਜੇ ਮਤਲਬ ਕਿ ਦੇਸ਼ਾਂ ਵਿੱਚ ਵੀ ਜ ਚਲਾ ਜਾਂਦਾ ਹੈ ਗੱਲ ਕਰੀਏ ਬਾਜ਼ ਦੀ ਜੋ ਕਿ ਮੇਰਾ ਫੇਵਰਟ ਪੰਛੀ ਹੈ ਅਤੇ ਇਸਦੀ ਨ ਇਸਦੀ ਨਿਗ੍ਹਾ ਬਹੁਤ ਜ਼ਿਆਦਾ ਤੇਜ਼ ਹੈ ਅਤੇ ਇਹ ਬਹੁਤ ਜ਼ਿਆਦਾ ਸ਼ਾਤਿਰ ਵੀ ਹੈ ਅਤੇ ਇੱਕ ਝਵੱਟੇ ਵਿੱਚ ਹੀ ਆਪਣੇ ਸ਼ਿਕਾਰ ਨੂੰ ਚੱਕ ਕੇ ਲੈ ਜਾਂਦਾ ਹੈ ਅਤੇ ਸ਼ਿਕਾਰ ਨੂੰ ਕੁਝ ਪਤਾ ਵੀ ਨਹੀਂ ਚੱਲਦਾ ਗੱਲ ਕਰੀਏ ਬਾਜ਼ ਦੀ ਤਾਂ ਬਾਜ਼ ਗੁਰੂ ਗੋਬਿੰਦ ਸਿੰਘ ਜੀ ਕੋਲ ਵੀ ਸੀਗਾ ਇਹ ਇਸ ਕਰਕੇ ਇਹ ਮੇਰਾ ਫੇਵਰਟ ਪੰਛੀ ਹੈ